ਭੰਗੜੇ ਦੇ ਆਮ ਸਟੈਪ ਮੱਠੀ ਚਾਲ ਝੂੰਮਰ ਫੁੱਲ ਤਾਰੀ ਧਨਕਾਰਾ ਫੁਲਕਾ ਹਾਥੀ ਚਾਲ ਮੋਰਚਾਲ ਧਮਾਲ ਆਦਿ ਇਸ ਤਰ੍ਹਾਂ ਕੁਛ ਸਟੈਪਸ ਹਨ ਭੰਗੜੇ ਨੂੰ ਸੱਭਿਆਚਾਰ ਦੇ ਜ਼ੋਰ ਦਾ ਅਤੇ ਜਸ਼ਨ ਵਾਲੇ ਸੁਭਾਅ ਵਿੱਚ ਅਸੀਂ ਢੋਲ ਨਾਲ ਭੰਗੜਾ ਪਾ ਸਕਦੇ ਹਾਂ ਬਾਂਸੁਰੀ ਦੀ ਮਦਦ ਲੈ ਸਕਦੇ ਹਾਂ ਕਾਟੋ ਦੀ ਮਦਦ ਲੈ ਸਕਦੇ ਹਾਂ ਤਬਲਾ ਵੀ ਬਜਾ ਸਕਦੇ ਹਾਂ ਇਸਦੇ ਵਿੱਚ ਹੋਹੋ ਹਾਹਾ ਦੀ ਮਦਦ ਨਾਲ ਅਸੀਂ ਸਟੇਜ ਨੂੰ ਹਿਲਾ ਸਕਦੇ ਹਾਂ ਇਸ ਤਰ੍ਹਾਂ ਭੰਗੜੇ ਨੂੰ ਜ਼ੋਰਦਾਰ ਅਤੇ ਜਸ਼ਨ ਦੇ ਸੁਭਾਅ ਵਿੱਚ ਮਨਾਇਆ ਜਾਂਦਾ ਹੈ ਅਤੇ ਬਹੁਤ ਹੀ ਧੂਮ ਧਾਮ ਦੀ ਪੇਸ਼ਕਸ਼ ਬਣਾਈ ਜਾ ਸਕਦੀ ਹੈ